ਹਾਂ ਜਦੋਂ ਮੈਂ ਆਪਣੀ ਫਰੈਂਡਸ ਨਾਲ ਟ੍ਰਿਪ 'ਤੇ ਗਈ ਸੀ ਤਾਂ ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਕਿਉਂਕਿ ਹੁਣ ਵੀ ਅੱਜ ਕੱਲ੍ਹ ਮੈਨੂੰ ਉਹ ਸੀਨਜ਼ ਜਿਹੜੀ ਉੱਥੇ ਦੀ ਬਿਊਟੀ ਸੀ ਮਾਊਨਟੇਂਨ ਸੀ ਪੀਕਸ ਸੀ ਬਹੁਤ ਯਾਦ ਆਉਂਦੇ ਨੇ ਕਿਉਂਕਿ ਅਸੀਂ ਆਪਣੇ ਟ੍ਰਿਪਸ ਨਾਲ ਟ੍ਰਿਪ 'ਤੇ ਗਏ ਸੀ ਆਪਣੀ ਫਰੈਂਡਸ ਨਾਲ ਬਹੁਤ ਜ਼ਿਆਦਾ ਇੰਨਜੋਆਏ ਕੀਤਾ ਫੋਟੋਸ ਕਲਿੱਕ ਕੀਤੀਆਂ ਉੱਥੇ ਦਾ ਜਿਵੇਂ ਆਪਾਂ ਕਹਿ ਦੋ ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਖਾਣ ਪੀਣ ਸੀ ਓਹ ਬਹੁਤ ਅੱਛਾ ਲੱਗਿਆ ਕਿਉਂਕਿ ਉਹ ਆਪਣੇ ਪੰਜਾਬ ਨਾਲੋਂ ਡਿਫਰੈਂਟ ਸੀ ਠੀਕ ਹੈ ਉਹ ਸੀਨੀਕ ਬਿਊਟੀ ਮੈਨੂੰ ਹੁਣ ਵੀ ਬਹੁਤ ਯਾਦ ਆਉਂਦੀ ਹੈ ਕਿਉਂਕਿ ਉਹ ਉਹਨਾਂ ਨਾਲ ਜਾਂ ਆਪਣੇ ਫਰੈਂਡਸ ਨਾਲ ਜਾਂਦੇ ਹਾਂ ਉਹ ਚੀਜ਼ਾਂ ਆਪਾਂ ਨੂੰ ਵਾਰ ਵਾਰ ਹੀ ਯਾਦ ਕਰਾਉਂਦੀਆਂ ਨੇ ਕਿ ਉੱਥੇ ਦੇ ਸਾਨੂੰ ਸੀਨਜ਼ ਸੀ ਬਿਊਟੀ ਸੀ ਬਹੁਤ ਜ਼ਿਆਦਾ ਅੱਛੀਆਂ ਲੱਗੀਆਂ ਤਾਂ ਸਾਨੂੰ ਐਂ ਲੱਗਦਾ ਕਿ ਉਹ ਜਦੋਂ ਅਸੀਂ ਘਰ ਆ ਜਾਂਦੇ ਹਾਂ ਤਾਂ ਸਾਨੂੰ ਓਹੀ ਚੀਜ਼ਾਂ ਵਾਰ ਵਾਰ ਦਿਖੀ ਜਾਂਦੀਆਂ ਨੇ ਕਿ ਉਹ ਪਹਾੜ ਕਿਵੇਂ ਦੇ ਸੀ ਮਾਊਂਨਟੇਨਸ ਕਿਵੇਂ ਦੇ ਸੀ ਉੱਥੇ ਦੀ ਸੀਨਿਕ ਬਿਊਟੀ ਕਿਵੇਂ ਦੀ ਸੀ ਉੱਥੇ ਦਾ ਖਾਣ ਪੀਣ ਹੋਰ ਸਾਰੀਆਂ ਚੀਜ਼ਾਂ ਸਾਨੂੰ ਵਾਰ ਵਾਰ ਇਹ ਚੀਜ਼ਾਂ ਯਾਦ ਕਰਾਉਂਦੀਆਂ ਨੇ ਅਤੇ ਉਹ ਸਾਡਾ ਐਕਸਪੀਅੰਸ ਬਹੁਤ ਅੱਛਾ ਰਿਹਾ ਥੈਂਕ ਯੂ